ਭੰਗੜਾ ਪੰਜਾਬ ਦਾ ਮੁੱਖ ਨਾਚ ਹੈ ਇਹ ਗੱਭਰੂਆਂ ਦੁਆਰਾ ਪਾਇਆ ਜਾਂਦਾ ਹੈ ਇਹ ਹਰ ਖੁਸ਼ੀ ਦੇ ਮੌਕੇ 'ਤੇ ਪਇਆ ਜਾਂਦਾ ਹੈ ਜਿਵੇਂ ਵਿਆਹ ਸ਼ਾਦੀਆਂ ਮੰਗਣੀ ਕਿਸੇ ਦੇ ਘਰ ਬੱਚਾ ਹੋਣ 'ਤੇ ਜਾਂ ਹੋਰ ਤਿਉਹਾਰ 'ਤੇ ਵੀ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਵਿਸਾਖੀ ਦੇ ਵਿਸਾਖੀ ਦੇ ਮੇਲੇ 'ਤੇ ਵੀ ਪਾਇਆ ਜਾਂਦਾ ਹੈ ਇਹ ਸਾਡੇ ਪੰਜਾਬ ਵਿੱਚ ਬਹੁਤ ਪ੍ਰਸਿੱਧ ਹੈ ਅੱਜ ਕੱਲ੍ਹ ਕੁੜੀਆਂ ਅਤੇ ਮੁੰਡੇ ਦੋਨਾਂ ਦੁਆਰਾ ਪਾਇਆ ਜਾਂਦਾ ਹੈ ਇਹ ਸਾਡੇ ਪੰਜਾਬ ਵਿੱਚ ਪੰਜਾਬ ਲਈ ਬਹੁਤ ਖਾਸ ਨਾਚ ਹੈ ਕਣਕ ਦੇ ਪੱਕਣ ਤੋਂ ਬਾਅਦ ਉਸ ਦੀ ਵਾਢੀ ਦੀ ਖੁਸ਼ੀ ਵਿੱਚ ਵਿਸਾਖੀ ਦੇ ਮੇਲੇ 'ਤੇ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਪਹਿਲਾਂ ਸ਼ੁਰੂ ਵਿੱਚ ਕਣਕ ਪੱਕਣ 'ਤੇ ਖੇਤਾਂ ਵਿੱਚ ਖੇਤਾਂ ਵਿੱਚ ਕਿਸਾਨਾਂ ਵੱਲੋਂ ਪਾਇਆ ਜਾਂਦਾ ਸੀ